ਹਾਂਜੀ ਬੋਲੀਵੁੱਡ ਅਤੇ ਟੋਲੀਵੁੱਡ ਨੇ ਭਾਰਤ ਵਿੱਚ ਹਰ ਥਾਂ 'ਤੇ ਫੈਸ਼ਨ ਰੁਝਾਨਾਂ ਨੂੰ ਪ੍ਰਭਾਵਿਤ ਕੀਤਾ ਵਾ ਅਤੇ ਉਹਨਾਂ ਵਿੱਚੋਂ ਸਾਰੀਆਂ ਪਾਤਰ ਮੈਨੂੰ ਪਸੰਦ ਵਾ ਅਤੇ ਜਿਨ੍ਹਾਂ ਵਿੱਚੋਂ ਲੈ ਕੇ ਕਰੀਨਾ ਕਪੂਰ ਮੈਨੂੰ ਬਹੁਤ ਪਸੰਦ ਵਾ ਜਾਂ ਸ਼ਿਲਪਾ ਸ਼ੈਟੀ ਬਹੁਤ ਪਸੰਦ ਵਾ ਉਹਨਾਂ ਦੀ ਲੁੱਕ ਬਹੁਤ ਸੋਹਣੀ ਆ ਸ਼ਕਲ ਬਹੁਤ ਸੋਹਣੀ ਆ ਉਹ ਗੱਲਬਾਤ ਬੜੇ ਤਰੀਕੇ ਨਾਲ ਕਰਦੇ ਆ ਅਤੇ ਜਿਹੜੇ ਉਹਨਾਂ ਦੇ ਕੱਪੜੇ ਆ ਉਹ ਵੀ ਬਹੁਤ ਪਸੰਦ ਸਾਨੂੰ ਅਤੇ ਉਹਨਾਂ ਨੂੰ ਲੈ ਕੇ ਅਸੀਂ ਕਦੀ ਨਹੀਂ ਕੋਈ ਇਵੇਂ ਦੀ ਗੱਲ ਕੀਤੀ ਪਰ ਉਹ ਫਿਲਮਾਂ 'ਚ ਹੀ ਕੱਪੜੇ ਚੱਲਦੇ ਆ ਆਮ ਜ਼ਿੰਦਗੀ ਵਿੱਚ ਨਹੀਂ ਪੈ ਸਕਦੇ ਅਸੀਂ ਕੋਸ਼ਿਸ਼ ਕਰਦੇ ਹਾਂ ਪਾਉਣ ਦੀ ਮਨ ਵੀ ਕਰਦਾ ਵਾ ਬੱਚਿਆਂ ਦਾ ਅਗਾਂਹ ਵੀ ਪਾਉਣ ਦਾ ਹਾਂ ਪੈਂਟਾਂ ਵਗੈਰਾ ਪਾ ਲੈਂਦੇ ਬੱਚੇ ਪਰ ਜਿਹੜੇ ਜ਼ਿਆਦਾ ਸ਼ੋਰਟਸ ਕੱਪੜੇ ਪਾਉਂਦੇ ਆ ਉਹ ਆਪਣੀ ਜ਼ਿੰਦਗੀ ਵਿੱਚ ਨਹੀਂ ਚੱਲ ਸਕਦੇ ਪਿੰਡਾਂ ਵਿੱਚ ਅਤੇ ਅਸੀਂ ਉਹਨਾਂ ਦੀਆਂ ਜਿਹੜੀਆਂ ਦੂਸਰੀਆਂ ਡਰੈੱਸਾਂ ਵਾ ਉਹਨਾਂ ਨੂੰ ਵੇਖ ਕੇ ਮੈਂ ਫਿਲਮਾਂ ਨੂੰ ਵੇਖ ਕੇ ਮੇਰਾ ਦਿਲ ਕਰਦਾ ਵਾ ਬਣਾਉਣ ਦਾ ਮੈਂ ਬਣਾਏ ਵੀ ਆਪਣੇ ਬੱਚਿਆਂ ਦੇ ਬਹੁਤ ਅਤੇ ਬੱਚੇ ਪਾ ਕੇ ਖੁਸ਼ ਵੀ ਹੁੰਦੇ ਆ ਪਰ ਇਹ ਆ ਕਿ ਜ਼ਿਆਦਾ ਸ਼ੋਰਟ ਨਹੀਂ ਬਣਾਉਂਦੇ ਕੁੜਤਾ ਸਟਾਈਲ ਬਣਾ ਲੈਂਦੇ ਆਪਾਂ ਲੰਬੇ ਬਣਾ ਲੈਂਦੇ ਥੋੜ੍ਹੇ ਅਤੇ ਉਹਨਾਂ ਨੂੰ ਵੇਖ ਕੇ ਮਨ ਖੁਸ਼ ਹੋ ਜਾਂਦਾ ਕਿ ਅਸੀਂ ਵੀ ਉਹਨਾਂ ਵਰਗੇ ਡਿਜਾਇਨਰ ਬਣ ਸਕਦੇ ਹਾਂ ਉਹਨਾਂ ਜਿਵੇਂ ਜਿਹੜੇ ਡਿਜ਼ਾਇਨਰ ਉਹਨਾਂ ਦੇ ਸੂਟ ਸਿਉਂਦੇ ਆ ਉਹਨਾਂ ਦੇ ਕੱਪੜੇ ਵੇਖ ਕੇ ਸਾਡਾ ਮਨ ਨੂੰ ਖੁਸ਼ ਹੁੰਦਾ ਵਾ ਅਸੀਂ ਪਾਉਂਦੇ ਵੀ ਹਾਂ ਅਤੇ ਥੋੜ੍ਹੇ ਲੰਬੇ ਪਾ ਲੈਂਦੇ ਅਸੀਂ ਆਮ ਛੋਟੇ ਕੱਪੜੇ ਨਹੀਂ ਪਾਉਂਦੇ